ਹੈਲੋ ਸਤਿ ਸ਼੍ਰੀ ਅਕਾਲ ਜੀ ਅਸੀਂ ਪਿੰਡ ਨਾਭਾ ਤੋਂ ਬੋਲ ਰਹੇ ਹਾਂ ਅਤੇ ਅਸੀਂ ਅਤੇ ਤੁਸੀਂ ਗੁਰਵਾ ਗੁਰਦੁਆਰਾ ਪ੍ਰਬੰਧਕ ਬੋਲ ਰਹੇ ਹੋ ਹਾਂਜੀ ਹਾਂਜੀ ਅਸੀਂ ਦੁਖਨਿਵਾਰਨ ਸਾਹਿਬ ਦਰਸ਼ਨ ਕਰਨ ਆਉਣਾ ਸੀਗਾ ਮੇਰੇ ਨਾਲ ਮੇਰੀ ਫੈਮਲੀ ਹੈ ਅਤੇ ਅਸੀਂ ਤੁਹਾਡੇ ਤੋਂ ਕੁਛ ਜਾਣਕਾਰੀ ਲੈਣਾ ਚਾਹੁੰਦੇ ਸਾਂ ਵੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਅਤੇ ਇਹ ਅਤੇ ਦਰਸ਼ਨ ਕਰਨ ਲਈ ਖਾਸ ਥਾਵਾਂ ਹੋਰ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਹਾਂਜੀ ਮੈਂ ਸੁਣਿਆ ਵੀ ਉਰੇ ਬਸੰਤ ਪੰਚਮੀ 'ਤੇ ਬਹੁਤ ਵੱਡਾ ਮੇਲਾ ਲੱਗਦਾ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਅਸੀਂ ਹਾਂਜੀ ਹੁਣ ਅਸੀਂ ਸੋਚ ਰਹੇ ਸੀਗੇ ਵੀ ਬਸੰਤ ਆਉਣ ਵਾਲੀ ਆ ਤਾਂ ਅਸੀਂ ਕਿਉਂ ਨਾ ਗੁਰਦੁ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਜਾ ਕੇ ਬਸੰਤ ਪੰਚਮੀ ਦਾ ਮੇਲਾ ਦੇਖੀਏ ਅਤੇ ਗੁਰੂ ਸਾਹਿਬਾਂ ਦੇ ਦਰਸ਼ਨ ਕਰੀਏ ਦੁੱਖ ਨਿਵਾਰੇ ਜਾਂਦੇ ਨੇ ਹਾਂਜੀ ਹਾਂਜੀ ਅੱਛਾ ਜੀ ਠੀਕ ਹੈ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ